ਇੱਕ ਲੱਖ ਇਕਾਸੀ ਹਜ਼ਾਰ ਦੋ ਸੌ ਪੰਜ ਤਿੰਨ ਲੱਖ ਛਿਹੱਤਰ ਹਜ਼ਾਰ ਤਿਹੱਤਰ ਪੰਜ ਲੱਖ ਉਣਹੱਤਰ ਹਜ਼ਾਰ ਨੌ ਸੌ ਨੜਿਨਵੇਂ ਸੱਤ ਲੱਖ ਅੱਸੀ ਹਜ਼ਾਰ ਅੱਠ ਸੌ ਦਸ ਨੌ ਲੱਖ ਪੈਂਹਠ ਹਜ਼ਾਰ ਪੰਜ ਸੌ ਇਕਤਾਲੀ